ਸਭ ਤੋਂ ਅਣਕਿਆਸੀ ਚੀਜ਼ ਜੋ ਮੇਰੇ ਨਾਲ ਵਾਪਰੀ ਹੈ ਠੀਕ ਹੈ ਨਾ ਉਹ ਇਹ ਹੈ ਕਿ ਜਿਵੇਂ ਮੈਂ ਕਿਤੇ ਵੀ ਜਾ ਰਿਹਾ ਵਾਂ ਕਿਤੇ ਟਰੈਕਿੰਗ ਕਰ ਰਿਹਾ ਵਾਂ ਜਾਂ ਕਿਤੇ ਯਾਤਰਾ 'ਤੇ ਨਿਕਲਿਆ ਵਾਂ ਉੱਥੇ ਸਫ਼ਾਈ ਦਾ ਨਹੀਂ ਮਤਲਬ ਮੈਂ ਵੇਖਿਆ ਸੀਗਾ ਲਾਸਟ ਟਾਇਮ ਮੈਂ ਗਿਆ ਸੀਗਾ ਨਾ ਅਤੇ ਸਫ਼ਾਈ ਨਹੀਂ ਸੀਗੀ ਸਫ਼ਾਈ ਦੀ ਬਹੁਤ ਜ਼ਿਆਦਾ ਦਿੱਕਤ ਸੀ ਮੈਨੂੰ ਲੋਕਾਂ ਨੇ ਏ ਤਰ੍ਹਾਂ ਹੀ ਗੰਦ ਪਾਇਆ ਹੋਇਆ ਆਪਣਾ ਖਾਧਾ ਪੀਤਾ ਆਪਣਾ ਇੰਜੋਏ ਕਰ ਲਿਆ ਉੱਥੇ ਸੁੱਟ ਗਏ ਉਹ ਦੂਜਿਆਂ ਵਾਸਤੇ ਕਿੰਨਾ ਨੁਕਸਾਨ ਆ ਉਹਨਾਂ ਨੂੰ ਨਹੀਂ ਇਸ ਗੱਲ ਦਾ ਪਤਾ ਠੀਕ ਆ ਆਮ ਜਨਤਾ ਵਾਸਤੇ ਤਾਂ ਹੈ ਹੀ ਹੈ ਨਾਲ ਨਾਲ ਜਾਨਵਰਾਂ ਵਾਸਤੇ ਵੀ ਬਹੁਤ ਮੁਸ਼ਕਲ ਹੁੰਦਾ ਆ ਉਹ ਬੇਚਾਰੇ ਵੀ ਚਲੋ ਉਹਨਾਂ ਦੀ ਵੀ ਲਾਈਫ ਹੈ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਸਫਰ ਕਰਨਾ ਪੈਂਦਾ ਏ ਤਰ੍ਹਾਂ ਹੀ ਪੋਲੋਥੀਨ ਸੁੱਟ ਦਿੰਦੇ ਉਹ ਅੱਗੋਂ ਐਨੀਮਲਸ ਈਟ ਕਰਦੇ ਨੇ ਕਿਉਂਕਿ ਉਹਨਾਂ ਨੂੰ ਖਾਣ ਵਾਸਤੇ ਲੱਭਣਾ ਪੈਂਦਾ ਅਤੇ ਉਹ ਫਿਰ ਉਹੀ ਗੰਦ ਮੰਦ ਖਾਂਦੇ ਨੇ ਅਤੇ ਬਹੁਤ ਗਲਤ ਲੱਗਦਾ ਮੈਨੂੰ ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਇੱਕ ਦੂਜੀ ਚੀਜ਼ ਇਹ ਆ ਕਿ ਲੋਕ ਸੱਭਿਅਤਾ 'ਚ ਨਹੀਂ ਰਹਿੰਦੇ ਮਤਲਬ ਉਹਨਾਂ ਨੂੰ ਬੋਲਣ ਦਾ ਤਰੀਕਾ ਨਹੀਂ ਪਤਾ ਕਿ ਯਾਰ ਆਂਢ ਗੁਆਂਢ 'ਚ ਕਿਸੇ ਦੀ ਕੋਈ ਫੈਮਲੀ ਚਲਦੀ ਹੋਣੀ ਆ ਜਾਂ ਕੋਈ ਆਪਣੇ ਵਧੀਆ ਤਰੀਕੇ ਨਾਲ ਜਾ ਰਿਹਾ ਹੋਣਾ ਤ ਤਾਂ ਆਪਾਂ ਮਤਲਬ ਉਹਨੂੰ ਇਸ ਵੇਅ ਨਾਲ ਮਤਲਬ ਆਪਾਂ ਆਪਸ 'ਚ ਗੱਲਾਂ ਕਰਦੇ ਕਿ ਦੂਜੇ ਨੂੰ ਚੰਗਾ ਨਹੀਂ ਲੱਗਦਾ ਜਾਂ ਆਈ ਲਾਈਕ ਗਾਲੀ ਗਲੋਚ ਦਾ ਯੂਸ ਕਰਨਾ ਠੀਕ ਆ ਨਾ ਚੰਗੇ ਸ਼ਬਦਾਂ ਦਾ ਨਹੀਂ ਪ੍ਰਯੋਗ ਕਰਨਾ ਅਤੇ ਉਹ ਸਭ ਚੀਜ਼ਾਂ ਗਲਤ ਹੈਗੀਆਂ ਨੇ ਅਤੇ ਜਿਵੇਂ ਜ਼ਿਕ ਜ਼ਿਕਰ ਕੀਤਾ ਗਿਆ ਕਿ ਟਰੈਕ ਦੇ ਦੌਰਾਨ ਮੈਂ ਫੋਟੋ ਕਲਿੱਕ 'ਤੇ ਹਾਂ ਮੈਂ ਸ਼ੌਕ ਆ ਮੈਨੂੰ ਫੋਟੋ ਕਲਿੱਕ ਕਰਨ ਦਾ ਮੈਂ ਜਿਵੇਂ ਕਿ ਕੋਈ ਵਧੀਆ ਸੀਨ ਆ ਜਾਵੇ ਉਸ ਜਗ੍ਹਾ 'ਤੇ ਮੈਂ ਉਹਦੀ ਫੋਟੋ ਕਲਿੱਕ ਕਰਦਾ ਹਾਂ ਜਾਂ ਆਪਣੀ ਖੁਦ ਦੀ ਸੈਲਫੀ ਲੈ ਲੈਂਦਾ ਅਤੇ ਉਹਨੂੰ ਫੇਰ ਸੋਸ਼ਲ ਮੀਡੀਆ ਪਲੇਟਫੋਰਮ 'ਤੇ ਮੈਂ ਪਾ ਦਿੰਦਾ ਤਾਂ ਕਿ ਜੋ ਲੋਕਾਂ ਨੂੰ ਮਤਲਬ ਮੈਂ ਦੱਸ ਸਕਾਂ ਕਿ ਹਾਂ ਮੈਂ ਇਸ ਜਗ੍ਹਾ 'ਤੇ ਵਿਜ਼ਿਟ ਕੀਤਾ ਹੈ ਅਤੇ ਜੇਕਰ ਮੈਨੂੰ ਚੀਜ਼ ਵਧੀਆ ਲੱਗਦੀ ਤਾਂ ਮੈਂ ਥੱਲੇ ਉਹਨੂੰ ਕੈਪਸ਼ਨ 'ਚ ਲਿਖਦਾ ਹਾਂ ਤਾਂ ਜੋ ਬਾਕੀ ਲੋਕ ਵੀ ਉਹਨੂੰ ਵਿਜ਼ਿਟ ਕਰ ਸਕਣ